ਅਸੀਂ ਜਾਨਵਰ ਜਿਵੇਂ ਸਾਡੇ ਮੁਕਤਸਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਨਾ ਮਾਘੀ ਦਾ ਮੇਲਾ ਲੱਗਦਾ ਉੱਥੇ ਵੱਖਰੇ ਵੱਖਰੇ ਜਾਨਵਰਾਂ ਦਾ ਮੇਲਾ ਵੀ ਲੱਗਦਾ ਹੈਗਾ ਜਾਨਵਰ ਮੇਲੇ ਤੋਂ ਵਿੱਚੋਂ ਹੀ ਅਸੀਂ ਆਪਦੇ ਜਾਨਵਰ ਖਰੀਦਦੇ ਹਾਂ ਇਹਨਾਂ ਦੀ ਕੀਮਤ ਜਿਵੇਂ ਹੁੰਦੀ ਹੈ ਅਸੀਂ ਉੱਥੇ ਵੱਖ ਵੱਖ ਤਰ੍ਹਾਂ ਦੇ ਕਬੂਤਰ ਹੋ ਗਏ ਵੱਖ ਵੱਖ ਤਰ੍ਹਾਂ ਦੇ ਤੋਤੇ ਹੋ ਗਏ ਅਤੇ ਹੋਰ ਕਈ ਜਾਨਵਰ ਹੋ ਗਏ ਉਹਨਾਂ ਦੇ ਵੱਖ ਵੱਖ ਕੀਮਤਾਂ ਹੁੰਦੀਆਂ ਜਿਵੇਂ ਕੋਈ ਪੰਜ ਹਜ਼ਾਰ ਦਾ ਹੋ ਗਿਆ ਕੋਈ ਛੇ ਹਜ਼ਾਰ ਦਾ ਹੋ ਗਿਆ ਦਸ ਹਜ਼ਾਰ ਤੱਕ ਦੇ ਵੀ ਉੱਥੇ ਜਾਨਵਰ ਮਿਲਦੇ ਹਨ ਅਤੇ ਅਸੀਂ ਉਹ ਜਾਨਵਰ ਮੇਲੇ ਦੇ ਵਿੱਚੋਂ ਹੀ ਆਪਣੇ ਵੱਖਰੇ ਵੱਖਰੇ ਜਾਨਵਰ ਦੀ ਚੋਣ ਕਰ ਲੈਂਦੇ ਹਾਂ ਜਿਵੇਂ ਕਿ ਹੋ ਗਿਆ ਚਿੱਟੇ ਕਬੂਤਰ ਵੀ ਮਿਲਦੇ ਆ ਉੱਥੋਂ ਉੱਥੋਂ ਚਿੜੀਆਂ ਸੋਨ ਪਹਾੜੀ ਚਿੜੀਆਂ ਹੋ ਗਈਆਂ ਹੋਰ ਰੰਗਾਂ ਵਾਲੀਆਂ ਚਿੜੀਆਂ ਹੋ ਗਈਆਂ ਸਭ ਤਰ੍ਹਾਂ ਦੇ ਜਾਨਵਰ ਉੱਥੋਂ ਮਿਲਦੇ ਆ ਜਿਵੇਂ ਛੋਟੇ ਹੋ ਗਏ ਜਾਨਵਰ ਕੁੱਤੇ ਹੋ ਗਏ ਬਿੱਲੀਆਂ ਹੋ ਗਈਆਂ ਖਰਗੋਸ਼ ਹੋ ਗਏ ਇਹ ਵਾਲੇ ਜਾਨਵਰ ਵੀ ਉੱਥੇ ਮਿਲਦੇ ਹਨ ਵੱਖ ਵੱਖ ਸਾਰੇ ਜਾਨਵਰਾਂ ਦੀਆਂ ਆਪਣੀ ਵੱਖ ਵੱਖ ਕੀਮਤ ਹੁੰਦੀ ਹੈ ਅਤੇ ਮੇਰੇ ਕੋਲ ਜਿਵੇਂ ਹੋ ਗਿਆ ਇੱਕ ਖਰਗੋਸ਼ ਹੈ ਅਤੇ ਅਤੇ ਦੋ ਚਿੜੀਆਂ ਹਨ ਰੰਗ ਬਿਰੰਗੀਆਂ ਚਿੜੀਆਂ ਛੋਟੀਆਂ ਛੋਟੀਆਂ ਜਿਨ੍ਹਾਂ ਨੂੰ ਮੈਂ ਦਾਣਾ ਵੀ ਪਾਉਂਦੀ ਹਾਂ ਛੋਟੇ ਜਿਹੇ ਪਿੰਜਰੇ ਵਿੱਚ ਰੱਖਦੀ ਹਾਂ ਉਹਨਾਂ ਨੂੰ ਬਾਹਰ ਵੀ ਕੱਢਦੀ ਹਾਂ ਖਰਗੋਸ਼ ਸਾਰਾ ਦਿਨ ਸਾਡੇ ਘਰ ਦੇ ਵਿੱਚ ਆਲੇ ਦੁਆਲੇ ਤੁਰਿਆ ਫਿਰਦਾ ਰਹਿੰਦਾ ਉਹਨੂੰ ਅਸੀਂ ਗਾਜਰ ਦਿੰਦੇ ਹਾਂ ਹੋਰ ਵੀ ਸਬਜ਼ੀਆਂ ਖਾਂਦਾ ਹੈ ਜਿਵੇਂ ਖਰਗੋਸ਼ ਇਹ ਜਿਵੇਂ ਹੁਣ ਮੈਂ ਚੋ ਜਿਹੜੀ ਦੋ ਚਿੜੀਆਂ ਰੰਗ ਬਿਰੰਗੀਆਂ ਚਿੜੀਆਂ ਸੀ ਉਹ ਮੈਂ ਜੋੜੇ 'ਚ ਖਰੀਦੀਆਂ ਸੀ ਉਹਨਾਂ ਦੀ ਕੀਮਤ ਸੀਗੀ ਪੰਜ ਹਜ਼ਾਰ ਰੁਪਈਆ ਅਤੇ ਜਿਹੜਾ ਖਰਗੋਸ਼ ਹੈ ਉਹ ਵੀ ਜੋੜੇ ਦੇ ਵਿੱਚ ਹੀ ਲਏ ਸੀ ਲਿਆ ਸੀਗਾ ਅਤੇ ਉਹਨਾਂ ਦੋਵਾਂ ਦੀ ਜਿਹੜੀ ਕੀਮਤ ਸੀਗੀ ਪੰਜ ਹਜ਼ਾਰ ਸੀਗੀ ਅਤੇ ਇਸ ਮਤਲਬ ਇਸ ਤਰ੍ਹਾਂ ਵੱਖੋ ਵੱਖਰੇ ਜਾਨਵਰ ਮਿਲਦੇ ਹਨ ਵੱਖਰੋ ਵੱਖਰੀ ਕੀਮਤਾਂ ਦੇ ਉੱਤੇ